ਦੁਨੀਆ ਵਿੱਚ ਹਰ ਇੱਕ ਬਿਮਾਰੀ ਦਾ ਹੱਲ ਹੈ ਜਿਵੇਂ ਕਿ ਕੈਂਸਰ ਟੀ ਬੀ ਅਤੇ ਹੋਰ ਕਈ ਹਾਰਨਿਕ ਬਿਮਾਰੀਆਂ ਦਾ ਵੀ ਹੱਲ ਹੈ ਪਰ ਵਹਿਮਾਂ ਭਰਮਾਂ ਦਾ ਕੋਈ ਇਲਾਜ ਨਹੀਂ ਹੈ ਪੂਰੇ ਭਾਰਤ ਵਿੱਚ ਅਤੇ ਕਈ ਰਾਜਾਂ ਅਤੇ ਹਰ ਇੱਕ ਇਲਾਕੇ ਵਿੱਚ ਵਹਿਮਾਂ ਵਹਿਮਾਂ ਭਰਮਾਂ ਨੂੰ ਉੱਤੇ ਬਹੁਤ ਹੀ ਭਾਰੀ ਤਰੀਕੇ ਨਾਲ ਵਿਸ਼ਵਾਸ ਕੀਤਾ ਜਾਂਦਾ ਹੈ ਜਿਵੇਂ ਕਿ ਕਈ ਕਈ ਲੋਕੀਂ ਆਖਦੇ ਹਨ ਕਿ ਭੁੱਖੇ ਪੇਟ ਘਰੋਂ ਬਾਹਰ ਨਹੀਂ ਜਾਣਾ ਭੁੱਖੇ ਪੇਟ ਘਰੋਂ ਬਾਹਰ ਜਾਣ ਨਾਲ ਅਸ਼ੁੱਭ ਹੁੰਦਾ ਹੈ ਅਤੇ ਕਈ ਲੋਕੀਂ ਇਹ ਵੀ ਮੰਨਦੇ ਹਨ ਕਿ ਕਾਲੀ ਬਿੱਲੀ ਜੇ ਰਾਸਤਾ ਕੱਟ ਜੇ ਤਾਂ ਉਸ ਰਾਸਤੇ ਤੋਂ ਕਦੇ ਅੱਗੇ ਨਹੀਂ ਜਾਣਾ ਚਾਹੀਦਾ ਇਸ ਨਾਲ ਬੰਦੇ ਦੀ ਮੌਤ ਹੋ ਜਾਂਦੀ ਹੈ ਅਤੇ ਕਈ ਹੋਰ ਵੀ ਤਰ੍ਹਾਂ ਦੇ ਵ ਵਹਿਮਾਂ ਭਰਮਾਂ ਉੱਤੇ ਲੋਕੀਂ ਵਿਸ਼ਵਾਸ ਕਰਦੇ ਹਨ ਜਿਵੇਂ ਕਿ ਜਿਵੇਂ ਕਿ ਕਿ ਘਰ ਦੇ ਬਾਹਰ ਸਵੇਰੇ ਸਵੇਰੇ ਨਿਕਲਣ ਲੱਗੇ ਪਾਣੀ ਡੋਲ ਕੇ ਨਿਕਲਣਾ ਚਾਹੀਦਾ ਹੈ ਅਤੇ ਕਈ ਲੋਕ ਜਾਦੂ ਟੂਣੇ ਅਤੇ ਤਾਂਤਰਿਕਾਂ ਤੋਂ ਵੀ ਜਾ ਕੇ ਇਹੋ ਜਿਹੇ ਕਈ ਵਹਿਮਾਂ ਭਰਮਾਂ ਦਾ ਇਲਾਜ ਕਰਵਾਉਂਦੇ ਹਨ ਪਰ ਅਸਲ ਵਿੱਚ ਇਹਨਾਂ ਵਹਿਮਾਂ ਭਰਮਾਂ ਉੱਤੇ ਸਾਨੂੰ ਕਦੇ ਵੀ ਯਕੀਨ ਨਹੀਂ ਕਰਨਾ ਚਾਹੀਦਾ ਜਿਵੇਂ ਕਿ ਕਈ ਹੋਰ ਵਹਿਮ ਭਰਮ ਹੈ ਕਿ ਘਰ ਘਰ ਪਏ ਝਾੜੂ ਦੇ ਉਪਰ ਟ ਟੱਪਣਾ ਨਹੀਂ ਚਾਹੀਦਾ ਅਤੇ ਉਹਨਾਂ ਉੱਤੇ ਪੈਰ ਨਹੀਂ ਰੱਖਣਾ ਚਾਹੀਦਾ ਸਾਨੂੰ ਹੋਰ ਤਰੀਕੇ ਨਾਲ ਇਹਨਾਂ ਵਹਿਮਾਂ ਭ ਭਰਮਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਇਹਨਾਂ ਨੂੰ ਨਿਗਲੈਕਟ ਕਰ ਦੇਣਾ ਚਾਹੀਦਾ ਹੈ ਇਹਨਾਂ ਦੇ ਨਾਲ ਧਿਆਨ ਨਹੀਂ ਦੇਣਾ ਚਾਹੀਦਾ